ਆਮ ਤੌਰ 'ਤੇ ਸਾਨੂੰ ਕੈਂਪਾਂ ਵਿੱਚ ਬਲੱਡ ਦੇਣਾ ਪੈਂਦਾ ਹੈ ਅਤੇ ਹੋਸਲਾ ਹੋਸਪਿਟਲਾਂ ਵਿੱਚ ਜਾ ਕੇ ਸਾਨੂੰ ਬਲੱਡ ਛੇਤੀ ਨਹੀਂ ਮਿਲਦਾ ਜਿਸ ਨਾਲ ਬੰਦੇ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ